ਮੈਨੂੰ ਮੇਰੀ ਸਹੇਲੀ ਤੋਂ ਪਤਾ ਲੱਗਿਆ ਕੀ ਤੁਹਾਡੇ ਗੈਸ ਸਲੰਡਰ ਦੀ ਸਰਵਿਸ ਬਹੁਤ ਵਧੀਆ ਹੈ ਕਿ ਤੁਹਾਡੇ ਸਿਲਿੰਡਰ ਜਲਦੀ ਤੋਂ ਜਲਦੀ ਪਹੁੰਚ ਜਾਂਦਾ ਹੈ ਜੇ ਤੁਹਾਡੇ ਸਿਲੰਡਰ ਕੀ ਸਰਵਿਸ ਬਹੁਤ ਵਧੀਆ ਹੈ ਤੇ ਤੁਹਾਡੇ ਤੁਸੀਂ ਅੱਗੇ ਤੋਂ ਅਸੀਂ ਤੁਹਾਨੂੰ ਹੀ ਸਿਲੰਡਰ ਦੀ ਬੁਕਿੰਗ ਵਾਸਤੇ ਕਵਾਂਗੇ ਤੇ ਤੁਹਾਡੇ ਨਾਲ ਹੀ ਸੰਪਰਕ ਕਰਾਂਗੇ ਤੇ ਤੁਹਾਡੀ ਗੈਸ ਏਜੰਸੀ ਨਾਲ ਜੁੜੇ ਰਵਾਂਗੇ ਤੇ ਤੁਹਾਡੇ ਏਜੰਸੀ ਦੀ ਸਰਵਿਸ ਬਹੁਤ ਵਧੀਆ ਹੈ ਤੇ ਅੱਗੇ ਤੋਂ ਤੁਹਾਡੇ ਨਾਲ ਹੀ ਵਧੀਆ ਜੁੜੇ ਰਹਾਂਗੇ ਤੁਹਾਡੇ ਕੋਲ ਹੀ ਕਾਲ ਕਰਕੇ ਸਿਲਿੰਡਰ ਮੰਗਵਾਵਾਂਗੇ ਤੇ ਤੁਹਾਡੀ ਅਸੀਂ ਹੋਰ ਵੀ ਕੋਈ ਅਗਰ ਕੰਮ ਪ੍ਰਤੀ ਕੋਈ ਕੁਛ ਵੀ ਗੈਸ ਦੇ ਲੋੜ ਜਰੂਰਤ ਹੋਵੇ ਤਾਂ ਤੁਹਾਡੀ ਕੋਲੋਂ ਸਰਵਿਸ ਲਵਾਂਗੇ ਅਸੀਂ ਕਿਤੋਂ ਹੋਰ ਵੀ ਪਤਾ ਕੀਤਾ ਲੇਕਿਨ ਉਹਨਾਂ ਦੀ ਸਰਵਿਸ ਸਹੀ ਨਹੀਂ ਸੀ ਤੇ ਤੁਹਾਡੀ ਸਰਵਿਸ ਸਾਨੂੰ ਬਹੁਤ ਵਧੀਆ ਲੱਗੀ ਤੇ ਇਸ ਕਰਕੇ ਤੁਹਾਡੇ ਨਾਲ ਹੀ ਸੰਪਰਕ ਕਰਾਂਗੀ